ਭਾਰਤੀ ਸਿੱਖਿਆ ਪ੍ਰਣਾਲੀ 'ਚ ਬਹੁਤ ਜ਼ਿਆਦਾ ਗਿਆ ਗੁਜ਼ਰਿਆ ਕੰਮ ਚੱਲ ਰਿਹਾ ਹੈ ਜਿਸ ਕਰਕੇ ਮੈਡਮਾਂ ਸਕੂਲਾਂ 'ਚ ਬੱਚਿਆਂ ਨੂੰ ਬਿਲਕੁਲ ਨਹੀਂ ਪੜ੍ਹਾਉਂਦੀਆਂ ਬੱਚੇ ਜਾਂਦੇ ਨੇ ਸਕੂਲ ਪਹਿਲਾਂ ਤਾਂ ਕਹਿੰਦੀਆਂ ਇਨ੍ਹਾਂ ਨੂੰ ਉਨ੍ਹਾਂ ਨੂੰ ਤੁਸੀਂ ਝਾੜੂ ਲਗਾਓ ਝਾੜੂ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕਹਿੰਦੀਆਂ ਤੁਸੀਂ ਡੇਕਸ ਸਾਫ ਕਰੋ ਡੈਕਸ ਸਾਫ ਕਰਨ ਤੋਂ ਬਾਅਦ ਉਹ ਕਹਿੰਦੀਆਂ ਕਿ ਸਾਡੇ ਵਾਸਤੇ ਚਾਹ ਬਣਾਓ ਉਨ੍ਹਾਂ ਪੜ੍ਹਾਉਣਾ ਕੀ ਹੈ ਉਹਨਾਂ ਦਾ ਆਪਣਾ ਬੁਣਨਾ ਹੀ ਨਹੀਂ ਖਤਮ ਹੁੰਦਾ ਜਿਸ ਕਰਕੇ ਅੱਜ ਕੱਲ੍ਹ ਬੱਚੇ ਬਿਲਕੁਲ ਨਹੀਂ ਪੜ੍ਹ ਰਹੇ ਜੇਕਰ ਕੋਈ ਬੱਚਿਆਂ ਨੂੰ ਜੋੜ ਦਾ ਸਵਾਲ ਵੀ ਪੁੱਛੇ ਦਸ ਵੀਹ ਦੇ ਬਾਰੇ ਪੁੱਛੇ ਉਹ ਵੀ ਨਹੀਂ ਬੱਚਿਆਂ ਨੂੰ ਪਤਾ ਜੇ ਗੱਲ ਪ੍ਰਾਈਮਰੀ ਸਕੂਲਾਂ ਦਾ ਇੰਨਾਂ ਬੁਰਾ ਹਾਲ ਹੈ ਗੌਰਮੈਂਟ ਕਹਿੰਦੀ ਹੈ ਪ੍ਰਾਈਮਰੀ ਸਕੂਲਾਂ 'ਚ ਪੜਾਓ ਬੱਚਿਆਂ ਨੂੰ ਕੀ ਪੜ੍ਹਾਈਏ ਪ੍ਰਾਇਮਰੀ ਸਕੂਲਾਂ 'ਚ ਪ੍ਰਾਇਮਰੀ ਸਕੂਲਾਂ 'ਚ ਤਾਂ ਬੱਚੇ ਜਾ ਕੇ ਹੋਰ ਵੀ ਬਦਨਾਮ ਹੋ ਰਹੇ ਨੇ ਜਿਸ ਕਰਕੇ ਕੁਝ ਨਸ਼ੇ ਸਿੱਖਦੇ ਕੋਈ ਬੀੜੀਆਂ ਪੀਣ ਲੱਗ ਗਏ ਕੋਈ ਜ਼ਰਦਾ ਖਾਣ ਲੱਗ ਗਿਆ ਮੈਡਮਾਂ ਕੋਈ ਰੋਕਦੀਆਂ ਨਹੀਂ ਆਪ ਆਪਣੀ ਮਰਜ਼ੀ ਨਾਲ ਬੱਚੇ ਆਉਂਦੇ ਨੇ ਆਪਣੀ ਮਰਜ਼ੀ ਦੇ ਨਾਲ ਬੱਚੇ ਚਲੇ ਜਾਂਦੇ ਨੇ ਇੰਨਾਂ ਬੁਰਾ ਹਾਲ ਸਰਕਾਰੀ ਸਕੂਲਾਂ ਦਾ